ਹਾਂਜੀ ਅਸੀਂ ਪੰਜਾਬ ਦੇ ਹੀ ਭਾਸ਼ਾ ਵਿੱਚ ਗੱਲ ਕਰਦੇ ਹਾਂ ਸਾਨੂੰ ਪੰਜਾਬੀ ਬਹੁਤ ਚੰਗੀ ਲੱਗਦੀ ਹੈ ਅਸੀਂ ਬਚਪਨ ਤੋਂ ਹੀ ਪੰਜਾਬੀ ਬੋਲਦੇ ਹਾਂ ਪੰਜਾਬੀ ਵਿੱਚ ਸਾਡੀ ਸਕੂਲ ਵਿੱਚ ਵੀ ਪੰਜਾਬੀ ਚੱਲਦੀ ਹੈ ਸਾਡਾ ਪਰਿਵਾਰ ਵੀ ਸਾਰਾ ਪੰਜਾਬੀ ਵਿੱਚ ਹੀ ਗੱਲ ਕਰਦਾ ਹੈ ਸਾਨੂੰ ਮਤਲਬ ਪੰਜਾਬੀ ਬੋਲਣਾ ਬਹੁਤ ਚੰਗਾ ਲੱਗਦਾ ਹੈ ਪੰਜਾਬ ਵਿੱਚ ਹੋਰ ਵੀ ਕਈ ਬੋਲੀਆਂ ਹਨ ਜਿਵੇਂ ਕਿ ਮਾਝੀ ਮਾਲਵੀ ਦੁਆਬੀ ਹੈ ਨਾ ਪੋ ਪੁਆਧੀ ਆਦਿ ਆਦਿ ਬਹੁਤ ਹਨ ਔਰ ਸਾਡੇ ਸਕੂਲ ਵਿੱਚ ਵੀ ਨਾ ਟੀਚਰ ਵੀ ਸਾਰੇ ਪੰਜਾਬੀ ਵਿੱਚ ਹੀ ਗੱਲ ਕਰਦੇ ਹਾਂ ਅਸੀਂ ਸ਼ੁਰੂ ਤੋਂ ਹੀ ਇੱਥੇ ਨਵਾਂਸ਼ਹਿਰ ਰਹਿ ਗਏ ਵੀ ਸਾਨੂੰ ਮਤਲਬ ਪੰਜਾਬੀ ਹੀ ਆਉਂਦੀ ਹੈ ਸਾਡੇ ਬੱਚੇ ਵੀ ਸਾ ਸਾਰੇ ਸਾਰੇ ਜਿੰਨੇ ਵੀ ਸਾਡਾ ਸਾਰਾ ਪਰਿਵਾਰ ਸਾਰਾ ਗੁਆਂਢ ਆਂ ਆਂਢ ਗੁਆਂਢ ਸਾਰਾ ਪੰਜਾਬੀ ਵਿੱਚ ਹੀ ਗੱਲ ਕਰਦਾ ਹੈ ਹਾਂਜੀ ਔਰ ਸਾਨੂੰ ਮਤਲਬ ਪੰਜਾਬੀ ਇੰਨੀ ਚੰਗੀ ਲੱਗਦੀ ਹੈ ਨਾ ਕਿ ਹੋਰ ਕੋਈ ਭਾਸ਼ਾ ਸਾਨੂੰ ਸਮਜ ਨਹੀਂ ਆਉਂਦੀ